ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਸਕੂਲ ਕੋਲਜ ਇੰਸਟੀਚਿਊਟ ਹਨ ਸਕੂਲ ਮੋਹਾਲੀ ਜ਼ਿਲ੍ਹੇ ਵਿੱਚ ਸਕੂਲ ਸਰਕਾਰੀ ਅਤੇ ਪ੍ਰਾਈਵੇਟ ਦੋਨੋਂ ਹਨ ਉਹ ਮਾਪੇ ਬੱਚਿਆਂ ਦੇ ਮਾਪੇ ਉਨ੍ਹਾਂ ਦਾ ਨੇੜੇ ਨਜ਼ਦੀਕੀ ਸਕੂਲ ਪ੍ਰਾਈਵੇਟ ਜਾਂ ਸਰਕਾਰੀ ਉਹ ਦੇਖ ਕੇ ਚੁਣਦੇ ਹਨ ਜੇਕਰ ਉਨ੍ਹਾਂ ਦਾ ਸਕੂਲ ਸਰਕਾਰੀ ਨੇੜੇ ਪੈ ਪੈਂਦਾ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਵਿੱਚ ਐਡਮੀਸ਼ਨ ਕਰਵਾਉਂਦੇ ਹਨ ਜਾਂ ਫਿਰ ਪ੍ਰਾਈਵੇਟ ਵਿੱਚ ਕਰਵਾਉਂਦੇ ਹਨ ਸਕੂ ਕੋਲਜ ਵਿੱਚ ਕਾਫੀ ਕੋਰਸ ਪਾਏ ਜਾਂਦੇ ਹਨ ਜਿਵੇਂ ਕਿ ਬੀ ਏ ਬੀ ਕੋਮ ਐੱਮ ਏ ਬਾਕੀ ਅ ਹੋਰ ਕੋਲਜਾਂ ਵਿੱਚ ਡਿਪਲੋਮਾਂ ਦੇ ਕੋਰਸ ਹੁੰਦੇ ਹਨ ਜਿਵੇਂ ਕਿ ਇਲੈਕਟ੍ਰੀਸ਼ਨ ਕਾ ਹੋ ਗਿਆ ਡਿਪਲੋਮਾ ਇੰਜਨੀਅਰਿੰਗ ਕਾ ਹੋ ਗਿਆ ਅਜਿਹੇ ਬਹੁਤ ਸਾਰੇ ਕੋਰਸ ਮੋਹਾਲੀ ਜ਼ਿਲ੍ਹੇ ਦੇ ਕੋਲਜਾਂ ਵਿੱਚ ਪਾਏ ਜਾਂਦੇ ਹਨ ਜਾਂ ਸਕੋ ਮਤਲਬ ਕਿ ਸਰਕਾਰੀ ਸਕੂਲਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਨਾਲ਼ੋਂ ਘੱਟ ਹੁੰਦੀ ਹੈ ਜਿਸ ਕਾਰਨ ਮਾਪੇ ਕਈ ਵਾਰ ਸਰਕਾਰੀ ਸਕੂਲ ਵਿੱਚ ਐਡਮੀਸ਼ਨ ਕਰਵਾਉਣੀ ਸਹੀ ਸਮਝਦੇ ਹਨ